ਪੰਜਾਬੀ ਸਾਡੀ ਮਾਂ ਬੋਲੀ ਹੈ ਇਸ ਤੋਂ ਹੀ ਕਾਫ਼ੀ ਸਾਰੇ ਸ਼ਬਦਾਂ ਤੋਂ ਹੀ ਵਾਕ ਬਣਦੇ ਨੇ ਗੇ ਅਤੇ ਇਹ ਵਾਕ ਵੀ ਮੇਰੇ ਕਾਫ਼ੀ ਪਸੰਦੀਦਾ ਨੇ ਵਾਕ ਹੁੰਦੇ ਨੇ ਜਿਹੜੇ ਕਿ ਸਾਨੂੰ ਸ਼ਬਦਾਂ ਤੋਂ ਪ੍ਰਦਾਨ ਕੀਤੇ ਜਾਂਦੇ ਨੇ ਗੇ ਮੈਨੂੰ ਪੰਜਾਬੀ ਹੋਣ 'ਤੇ ਵੀ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿਉਂਕਿ ਇਹ ਇੱਕ ਤਾਂ ਇਹ ਮੇਰੀ ਮਾਂ ਬੋਲੀ ਹੈ ਅਤੇ ਇੱਕ ਮੇਰੀਆਂ ਇਹ ਫੀਲਿੰਗਸ ਨੂੰ ਵੀ ਐਕਸਪ੍ਰੈਕਸ ਕਰਦੀ ਹੈ ਬਹੁਤ ਹੀ ਚੰਗੇ ਤਰੀਕੇ ਨਾਲ ਪੰਜਾਬੀ ਦੀਆਂ ਕਾਫ਼ੀ ਉਪ ਭਾਸ਼ਾਵਾਂ ਨੇ ਜਿਵੇਂ ਮਲਵਈ ਪੋਠੋਹਾਰੀ ਦੁਆਬੀ ਹਰੇਕ ਪੰਜਾਬ ਦੇ ਖੇਤਰ ਵਿੱਚ ਅਲੱਗ ਅਲੱਗ ਤਰ੍ਹਾਂ ਦੀ ਪੰਜਾਬੀ ਬੋਲੀ ਜਾਂਦੀ ਹੈ ਤਾਂ ਕਿ ਜਿਹੜੀ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਇਲਾਕਿਆਂ ਤੋਂ ਵੀ ਵੱਖ ਵੱਖ ਕਰ ਦਿੰਦੀ ਹੈ ਅਤੇ ਪੰਜਾਬੀ ਸਾਡੇ ਬਹੁਤ ਹੀ ਉੱਚੇ ਜੇ ਪੱਧਰਾਂ 'ਤੇ ਪਹੁੰਚ ਚੁੱਕੀ ਹੈ ਇਸ ਨੇ ਬਹੁਤ ਹੀ ਜ਼ਿਆਦਾ ਉਪਲੱਬਧੀਆਂ ਹਾਸਿਲ ਕੀਤੀਆਂ ਨੇ ਇਸ ਵਿੱਚ ਕਾਫ਼ੀ ਹੀ ਵਿਆਕਰਨ ਵਿੱਚ ਸਮਾਈ ਹੋਈ ਹੈ ਜਿਹਦੇ ਨਾਲ ਕਿ ਸਾਨੂੰ ਪੰਜਾਬੀ ਪੜ੍ਹਨ ਵਿੱਚ ਕੋਈ ਵੀ ਮੁਸ਼ਕਿਲ ਨਹੀਂ ਆਉਂਦੀ ਅੱਜ ਕੱਲ੍ਹ ਦੀ ਦੁਨੀਆਂ ਦੇ ਵਿੱਚ ਪਰ ਪੰਜਾਬੀ ਤਾਂ ਗਾਇਕਾਂ ਨੇ ਵੀ ਇਸ ਨੂੰ ਬੜਾ ਹੀ ਵਧੀਆ ਉੱਚੇ ਲੈਵਲ 'ਤੇ ਪਹੁੰਚਾਇਆ ਹੈ ਕਿਉਂਕਿ ਓਹ ਵੀ ਪੰਜਾਬੀ ਹਨ ਅਤੇ ਉਨ੍ਹਾਂ ਨੇ ਪੰਜਾਬ ਪੰਜਾਬ ਹੈ ਤਾਂ ਛੋਟਾ ਜਾ ਪਰ ਇਹ ਸਾਰੇ ਹੀ ਪਾਸੇ ਫੈਲਿਆ ਹੋਇਆ ਹੈ ਅਤੇ ਇਹਦੀ ਪੰਜਾਬੀ ਵੀ ਹਰੇਕ ਥਾਂ 'ਤੇ ਹੀ ਮਸ਼ਹੂਰ ਹੈ ਕਿਉਂਕਿ ਲੋਕ ਪੰਜਾਬੀ ਵੀ ਬੋਲਦੇ ਨੇ ਅੱਜ ਕੱਲ੍ਹ ਤਾਂ ਜਿਹੜੇ ਲੋਕ ਵਿਦੇਸ਼ ਵਿੱਚ ਵੀ ਰਹਿ ਰਹੇ ਨੇ ਗੇ ਉਨ੍ਹਾਂ ਨੇ ਵੀ ਪੰਜਾਬੀ ਨੂੰ ਬਹੁਤ ਵਧਾ ਚੜ੍ਹਾ ਕੇ ਪ੍ਰਦਾਨ ਕੀਤਾ ਹੈ ਸਾਰੇ ਲੋਕਾਂ ਦੁਆਰਾ